ਸਥਾਨਕ ਅਖਬਾਰ ਵਿੱਚ ਸਥਾਨਕ ਸੱਭਿਆਚਾਰਕ ਸਮਾਗਮਾਂ ਨੂੰ ਕਈ ਜਗ੍ਹਾ ਕਵਰ ਕੀਤਾ ਜਾਂਦਾ ਹੈ ਕਈ ਵੱਖ ਵੱਖ ਜ਼ਿਲ੍ਹੇ ਕਈ ਵੱਖ ਵੱਖ ਸਕੂਲ ਕਾਲਜਾਂ ਵਿੱਚ ਹੋ ਰਹੇ ਸੱਭਿਆਚਾਰਿਕ ਦ੍ਰਿਸ਼ ਪੇਸ਼ ਕੀਤੇ ਜਾਂਦੇ ਹਨ ਹੁਣੇ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੱਕ ਵਿੱਚ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਉੱਥੇ ਦੇ ਯੂਥ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦਰਸ਼ਾਇਆ ਹੈ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਨਾਟਕ ਰੂਪੀ ਪੇਸ਼ ਕੀਤਾ ਗਿਆ ਹੈ ਜਿਹਨਾਂ ਨੂੰ ਬੜੇ ਹੀ ਭਾਵਕ ਸੰਜੀਦਾ ਔਰ ਬੜੇ ਹੀ ਸੋਹਣੇ ਤਰੀਕੇ ਨਾਲ ਹਾਜ਼ਰੀਨ ਦੇ ਸਮਕਸ਼ ਪੇਸ਼ ਕੀਤਾ ਗਿਆ ਹੈ ਜਿਹਦੇ ਨਾਲ ਹਾਜ਼ਰ ਨੇ ਬੜੇ ਭਾਵਕ ਹੋ ਹੋ ਗਏ ਸੀ ਇਸ ਤੋਂ ਇਲਾਵਾ ਛੋਟੇ ਛੋਟੇ ਵਿਦਿਆਰਥੀਆਂ ਦੇ ਰੰਗਾਂ ਰੰਗ ਪ੍ਰੋਗਰਾਮ ਕੀਤਾ ਪੇਸ਼ ਕੀਤਾ ਗਿਆ ਹੈ ਕਾਲਜ ਦੇ ਪ੍ਰੋਗਰਾਮ ਤੋਂ ਬਾਅਦ ਲੰਗਰ ਅਤੇ ਕੜਾਹ ਪ੍ਰਸ਼ਾਦ ਅਤੇ ਅਰਦਾਸ ਵੀ ਕੀਤੀ ਗਈ ਹੈ ਜੋ ਕਿ ਬੜੇ ਹੀ ਸੱਭਿਆਚਾਰਿਕ ਸਥਿਤੀ ਦਾ ਵੇਰਵਾ ਦਰਸ਼ਾਂਦਾ ਹੈ